ਮੋਬਾਈਲ ਵਰਤਣ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ ਇਹ ਆ ਰਹੀ ਹੈ ਜਿਆਦਾ ਮੋਬਾਈਲ ਵਰਤਣ ਦੇ ਨਾਲ ਪਹਿਲੀ ਗੱਲ ਤਾਂ ਇਹ ਹੈ ਲੋਕਾਂ ਦੀ ਅੱਖਾਂ ਦੀ ਪ੍ਰੋਬਲਮ ਵਧਣੀ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੀ ਅੱਜ ਕੱਲ ਮੋਬਾਈਲ ਟੈਕਨੋਲੋਜੀ ਅਸੀ ਯੂਜ ਕਰਦੇ ਪਏ ਹੈਗੇ ਆ ਉਹ ਸਾਡੀ ਅੱਖਾਂ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਅੱਜ ਕੱਲ ਜਿਹੜਾ ਇੱਕ ਆਪਾਂ ਕਹਿ ਸਕਦੇ ਆ ਕਿ ਜਿਹੜਾ ਬੰਦਾ ਹੈਗਾ ਹੈ ਉਹ ਦਿਨ ਦੇ ਵਿੱਚ ਕੰਮ ਘੱਟ ਤੋਂ ਘੱਟ ਨਹੀਂ ਤੇ ਪੰਜ ਤੋਂ ਛੇ ਘੰਟੇ ਆਪਣਾ ਜਿਹੜਾ ਮੋਬਾਈਲ ਦੇਖਦਾ ਹੈ ਉਹਦੇ ਕਰਕੇ ਕੀ ਹੈਗਾ ਕਿ ਸਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਅੱਖਾਂ ਦਾ ਵਿੱਚ ਜਿਹੜਾ ਮੋਬਾਈਲ ਦੀ ਲਾਈਟ ਪੈਂਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਯੂ ਵੀ ਰੇਸ ਉਹ ਸਾਡੀ ਅੱਖਾਂ ਲਈ ਬਿਲਕੁਲ ਚੰਗੀਆਂ ਨਹੀਂ ਹੈਗੀਆਂ ਦੂਜੀ ਗੱਲ ਮੋਬਾਇਲ ਵਰਤਣ ਦੇ ਨਾਲ ਸਾਡੇ ਦਿਮਾਗ ਦੇ ਵਿੱਚ ਅਸਰ ਪੈਂਦਾ ਹੈ ਸਾਡੇ ਜਿਦਾਂ ਅੱਜ ਕੱਲ ਬਹੁਤ ਸਾਰੇ ਐਪਸ ਚੱਲਦੇ ਹੈ ਸਾਰਾ ਦਿਨ ਆਪਾਂ ਉਹਨਾਂ ਨੂੰ ਵੀਡੀਓ ਨੂੰ ਜਿਹੜੀ ਆਪਣੀ ਆਉਂਦੀਆਂ ਉਹਨਾਂ ਨੂੰ ਸਕਰੋਲ ਕਰਦੇ ਰਹਿਦੇ ਹਾਂ ਤੇ ਉਹਦੇ ਨਾਲ ਸਾਡਾ ਜਿਹੜਾ ਹੈ ਬਹੁਤ ਜਿਆਦਾ ਟਾਈਮ ਵੀ ਖਰਚ ਹੁੰਦਾ ਹੈ ਜਿਹੜਾ ਕਿ ਬਿਲਕੁਲ ਚੰਗੀ ਗੱਲ ਨਹੀਂ ਹੈ ਤੇ ਨਾਲੇ ਸਾਡੇ ਦਿਮਾਗ ਤੇ ਅਸਰ ਤਾਂ ਪੈਂਦਾ ਹੀ ਪੈਂਦਾ ਹੈ ਤੇ ਜਿਆਦਾ ਫੋਨ ਯੂਜ ਕਰਨਾ ਕਈ ਬੰਦੇ ਘੰਟੋ ਘੰਟੋ ਮੋਬਾਈਲ ਤੇ ਗੱਲਾਂ ਕਰਦੇ ਰਹਿੰਦੇ ਹਨ ਜੋ ਕਿ ਬਿਲਕੁਲ ਸਹੀ ਨਹੀਂ ਹੈ ਸੋ ਮੈਂ ਆਹੀ ਦੱਸਣਾ ਚਾਹੁੰਦਾ ਕਿ ਮੋਬਾਇਲ ਦੀ ਵਰਤੋਂ ਸਹੀ ਤਰੀਕੇ ਤੇ ਸਹੀ ਟਾਈਮ ਵਜੋਂ ਕਰੋ ਕਿ ਤੁਹਾਨੂੰ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਦਿੱਕਤ ਨਾ ਆਵੇ